ਪੰਜਾਬ ਵਿੱਚ ਪੰਜਾਬ ਵਿੱਚ ਮੁੱਖ ਟੈਕਨੋਲੋਜੀ ਰੁਝਾਨ ਦਾ ਬੜਾ ਜ਼ਿਆਦਾ ਵਿਕਾਸ ਹੋਇਆ ਹੈ ਅਸੀਂ ਪਹਿਲਾਂ ਹਰ ਇੱਕ ਚੀਜ਼ ਪਹਿਲਾਂ ਰਜਿਸਟਰਾਂ 'ਤੇ ਕਰਦੇ ਸੀ ਹੱਥਾਂ ਨਾਲ ਕਰਦੇ ਸੀ ਪਰ ਅੱਜ ਕੱਲ੍ਹ ਅਸੀਂ ਕੰਪਿਊਟਰਾਇਜ਼ ਚੀਜ਼ਾਂ ਕਰਨ ਲੱਗ ਪਏ ਹਾਂ ਅਸੀਂ ਬੜੀ ਚੀਜ਼ਾਂ ਨੂੰ ਕੰਪਿਊਟਰ 'ਚ ਕਰਨ ਲੱਗ ਪਏ ਇੰਟਰਨੇਟ ਦੀ ਬੜੀ ਸਾਨੂੰ ਹੋਰ ਲੋੜ ਪੈਣ ਲੱਗ ਪਈ ਹੈ ਅੱਜ ਕੱਲ੍ਹ ਅਸੀਂ ਪਹਿਲਾਂ ਜਦੋਂ ਅ ਜਦੋਂ ਅਟੈਂਡੈਂਸ ਲਗਾਉਣੀ ਹੁੰਦੀ ਅਸੀਂ ਪਹਿਲਾਂ ਰਜਿਸਟਰਾਂ 'ਤੇ ਲਾਉਂਦੇ ਸੀ ਹੁਣ ਅਸੀਂ ਆਪਣਾ ਖੁਦ ਬਾਇਓਮੈਟ੍ਰਿਕਸ 'ਤੇ ਲਾਉਂਦੇ ਹੈ ਹੁਣ ਅਸੀਂ ਅੰਗੂਠਾ ਲਾ ਕੇ ਸਿੱਧਾ ਉਹਨੂੰ ਥੰਬ ਪ੍ਰਿੰਟ ਨਾਲ ਉੱਥੇ ਅਸੀਂ ਬਾਇਓਮੈਟ੍ਰਿਕਸ ਲਾਉਂਦੇ ਹਾਂ ਆਪਣੇ ਸਾਡੇ ਇੱਥੇ ਇੰਡਸਟਰੀ 'ਚ ਬੜੇ ਜ਼ਿਆਦਾ ਸਮਾਰਟ ਡਿਵਾਇਸਿਸ ਆ ਗਏ ਆ ਡਿਜੀਟਲ ਚੀਜ਼ਾਂ ਬੜੀਆਂ ਵੱਧ ਗਈਆਂ ਵਾ ਠੀਕ ਹੈ ਅਸੀਂ ਉਹਦੇ ਨਾਲ ਬੜੀ ਛੇਤੀ ਛੇਤੀ ਅਸੀਂ ਕੰਮ ਕਰ ਲੈਂਦੇ ਹਾਂ ਅਸੀਂ ਜਦੋਂ ਵੀ ਕੋਈ ਵੀ ਚੀਜ਼ ਹੋਵੇ ਪਹਿਲਾਂ ਅਸੀਂ ਲਿਖਦੇ ਸੀ ਫੇਰ ਉਹਨੂੰ ਬਾਅਦ 'ਚ ਦੂਰ ਜਾ ਕੇ ਕਰਦੇ ਸੀ ਜਿੱਥੇ ਇੰਟਰਨੈੱਟ ਹੁੰਦਾ ਸੀ ਪਰ ਅੱਜ ਕੱਲ੍ਹ ਹਰ ਜਗ੍ਹਾ ਇੰਟਰਨੈੱਟ ਪੁਹੰਚ ਗਿਆ ਵਾ ਹਰ ਜਗ੍ਹਾ ਇੰਟਰਨੈੱਟ ਦੀ ਸਾਨੂੰ ਵਰਤੋਂ ਕਰਨੀ ਆ ਗਈ ਆ ਜ਼ਿਆਦਾਤਰ ਹਰ ਕਿਸੇ ਨੂੰ ਇੰਟਰਨੈੱਟ ਦੀ ਵਰਤੋਂ ਕਰਨੀ ਆ ਗਈ ਹੈ ਅਤੇ ਉਹ ਸਾਡੇ ਲਈ ਅਤੇ ਸਾਰਿਆਂ ਲਈ ਬੜੀ ਵਧੀਆ ਚੀਜ਼ ਆ